ਭੰਗੜੇ ਦੇ ਵਿੱਚ ਉੱਛਲ ਕੂਦ ਬਹੁਤ ਹੁੰਦੀ ਹੈ ਐਰੋਬਿਕ ਫਿਟਨੈਸ ਲਈ ਵੀ ਆਪਾਂ ਨੂੰ ਉੱਛਲ ਕੂਦ ਕਰਨਾ ਹੁੰਦਾ ਭੱਜਣਾ ਹੁੰਦਾ ਛਾਲਾਂ ਮਾਰਨੀਆਂ ਹੁੰਦੀਆਂ ਪਸੀਨਾ ਵਹਾਉਣਾ ਹੁੰਦਾ ਤਾਂ ਕਿ ਬਾਅਦ ਦੇ ਵਿੱਚ ਆਪਣਾ ਸਾਹ ਚੜ੍ਹੇ ਉਹੀ ਚੀਜ਼ ਭੰਗੜੇ 'ਚ ਹੁੰਦੀ ਹੈ ਭੰਗੜੇ ਦੇ ਵਿੱਚ ਆਪਾਂ ਜਿੰਨਾ ਵੀ ਨੱਚਦੇ ਹਾਂ ਉਸ ਤੋਂ ਬਾਅਦ ਬਹੁਤ ਪਸੀਨਾ ਆਉਂਦਾ ਐਰੋਬਿਕ ਫਿਟਨੈਸ ਨੋਰਮਲ ਜੇ ਆਪਾਂ ਦੇਖੀਏ ਤਾਂ ਉਹ ਬੰਦਾ ਅੱਗੇ ਆਉਂਦਾ ਉਸ 'ਚ ਭੰਗੜੇ ਦੇ ਨਾਲ ਨਾਲ ਪਿੱਛੇ ਸੁਰ ਚੱਲ ਰਹੇ ਹੁੰਦੇ ਆ ਤਾਂ ਬੰਦਾ ਅੱਕਦਾ ਨਹੀਂ ਓਥੋਂ ਦੇ ਝੂਮਰ ਲੁੱਡੀਆਂ ਹਾਥੀ ਚਾਲ ਅਤੇ ਹੋਰ ਪਤਾ ਨਹੀਂ ਕੀ ਕੀ ਕਰਕੇ